ਹੈਲੋ ਹਾਂਜੀ ਸਰ ਤੁਸੀਂ ਆਦੇਸ਼ ਪੋਲੀਟੈਕਨਿਕ ਵਿਚ ਪੜਦੇ ਤੇ ਅੱਛਾ ਤੇ ਸਰ ਤੁਸੀਂ ਥਰਡ ਏਅਰ ਦੇ ਸਟੂਡੈਂਟ ਹੋ ਅੱਛਾ ਜੀ ਸਰ ਮੇਰੀ ਵੀ ਐਡਮਿਸ਼ਨ ਆਦੇਸ਼ ਪੋਲੀਟੈਕਨ ਵਿੱਚ ਹੋਈ ਐ ਤੇ ਫਿਰ ਮੈਂ ਇੱਥੇ ਕੀ ਕਹਿੰਦੇ ਨੇ ਹਾਂਜੀ ਹਾਂਜੀ ਹਾਂਜੀ ਮੈਂ ਫਸਟ ਸਮੈਸਟਰ ਦੀ ਸਟੂਡੈਂਟ ਆ ਤੇ ਮੈਂ ਸਰ ਬਿਲੋਂਗ ਕਰਦੀ ਆਂ ਰਾਜਸਥਾਨ ਦੇ ਜੈਸਲਮੇਰ ਏਰੀਏ ਤੋਂ ਤੇ ਜੈਸਲਮੇਰ ਤੋਂ ਅਸੀਂ ਮੈਂ ਇੱਥੇ ਪੜਣ ਆਣਾ ਪੰਜਾਬ ਦੇ ਵਿੱਚ ਤੇ ਮੈਂ ਸਿਰਫ ਤੁਹਾਡੇ ਤੋਂ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਸੀ ਕਿ ਇਹ ਕਲਾਸਿਸ ਜਿਹੜੀਆਂ ਹੈਗੀਆਂ ਨੇ ਆਪਣੀਆਂ ਜੁਲਾਈ ਤੋਂ ਸ਼ੁਰੂ ਹੋਣੀਆਂ ਤੇ ਸਰ ਤੁਸੀਂ ਮੈਨੂੰ ਥੋੜਾ ਜਿਹਾ ਗਾਈਡ ਕਰੋ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਇਥੇ ਮੌਨਸੂਨ ਦਾ ਮੌਸਮ ਐ ਸਰਦੀ ਗਰਮੀ ਦਾ ਮੌਸਮ ਹੁੰਦਾ ਹੈ ਤੇ ਮੈਨੂੰ ਇਸ ਹਾਂਜੀ ਜੀ ਫੋਟੀਫਾਈਵ ਡਿਗਰੀ ਹੁੰਦਾ ਹਾਂਜੀ ਠੀਕ ਐ ਜੀ ਹਾਂਜੀ ਠੀਕ ਐ ਜੀ ਤੇ ਸਰ ਫਿਰ ਮੈਨੂੰ ਕੱਪੜੇ ਕਿਤਾ ਕੈਰੀ ਕਰਨੇ ਚਾਹੀਦੇ ਨੇ ਜਾਂ ਜਿਆਦਾ ਬਾਰਿਸ਼ ਹੁੰਦੀ ਐ ਤਾਂ ਆਪਣੇ ਕੋਸ਼ਨਰੀ ਮੈਨੂੰ ਕੋਈ ਬਰਸਾਤੀ ਵਗੈਰਾ ਠੀਕ ਐ ਜੀ ਠੀਕ ਐ ਜੀ ਤੇ ਕੱਪੜੇ ਸਰ ਸਮਝਦੇ ਹਿਸਾਬ ਤੇ ਲੈ ਕੇ ਆਵਾਂ ਫਿਰ ਵੀ ਕਾਟਨ ਠੀਕ ਐ ਜੀ ਤੇ ਸਰ ਇਸ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ ਥੋੜਾ ਜਿਹਾ ਕਿ ਜਿਵੇਂ ਜਸਟ ਉਸ ਤੋਂ ਬਾਅਦ ਠੀਕ ਹੈ ਜੀ ਹਾਂਜੀ ਬਸ ਇਹੀ ਪੁੱਛਣਾ ਸੀ ਜੀ ਮੇਨ ਤਾਂ ਠੀਕ ਓਕੇ ਚਲੋ ਠੀਕ ਐ ਜੀ ਓਕੇ